ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਹਨ ਇੱਕ ਚੰਗਾ ਪਹਿਲੂ ਹੁੰਦਾ ਹੈ ਅਤੇ ਦੂਸਰਾ ਬੁਰਾ ਪਹਿਲੂ ਹੁੰਦਾ ਹੈ ਉਵੇਂ ਹੀ ਹੈ ਸਾਡੀ ਟੈਕਨੋਲੋਜੀ ਅੱਜ ਕੱਲ੍ਹ ਅਸੀਂ ਉਸੇ ਜ਼ਮਾਨੇ ਵਿੱਚ ਜੀਅ ਰਹੇ ਹਾਂ ਜਿਸ ਦੇ ਵਿੱਚ ਟੈਕਨੋਲੋਜੀ ਨੇ ਸਾਰਾ ਕੁਝ ਹੀ ਬਦਲ ਕੇ ਰੱਖ ਦਿੱਤਾ ਹੈ ਜੇਕਰ ਅਸੀਂ ਗੱਲ ਕਰੀਏ ਟੈਕਨੋਲੋਜੀ ਦੀ ਤਾਂ ਤਕਨੋਲੋਜੀ ਦੇ ਬਹੁਤ ਸਾਰੇ ਹੀ ਫਾਇਦੇ ਹਨ ਅਤੇ ਉਸ ਨਾਲ ਉਸ ਤੋਂ ਦੁਗਣੇ ਨੁਕਸਾਨ ਹਨ ਜੇਕਰ ਮੈਂ ਗੱਲ ਕਰਾਂ ਕਿ ਬੱਚੇ ਅਤੇ ਟੈਕਨੋਲੋਜੀ ਦੇ ਨੁਕਸਾਨ ਕੀ ਕੀ ਹਨ ਤਾਂ ਉਹ ਇਸ ਪ੍ਰਕਾਰ ਹਨ ਕਿ ਜੋ ਬੱਚੇ ਟੈਕਨੋਲਜੀ ਨੂੰ ਸਦਉਪਯੋਗ ਕਰਨ ਤੋਂ ਇਲਾਵਾ ਉਸਦਾ ਦੁਰਉਪਯੋਗ ਕਰਦੇ ਹਨ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਟੈਕਨੋਲੋਜੀ ਨਹੀਂ ਸਾਡੇ ਕੋਲ ਫੋਨ ਇੰਟਰਨੈਟ ਸਭ ਕੁਝ ਮਿਲਿਆ ਹੈ ਅਸੀਂ ਉਸ ਵਿੱਚ ਚੰਗੀਆਂ ਚੀਜ਼ਾਂ ਸਿੱਖ ਸਕਦੇ ਹਾਂ ਪੜ੍ਹਾਈ ਬਾਰੇ ਵੀ ਸਿੱਖ ਸਕਦੇ ਹਾਂ ਪਰ ਬੱਚੇ ਇਸ ਤਰ੍ਹਾਂ ਨਹੀਂ ਕਰਦੇ ਬੱਚੇ ਹੋਰ ਸ਼ੋਸ਼ਲ ਮੀਡੀਆ ਐਪਾਂ ਵੱਲ ਜ਼ਿਆਦਾ ਆਕਰਸ਼ਿਤ ਹੁੰਦੇ ਹਨ ਅਤੇ ਉਹ ਭਰ ਕੇ ਉਹ ਡਾਊਨਲੋਡ ਕਰਕੇ ਉਹ ਉਹੀ ਚਲਾਉਂਦੇ ਰਹਿੰਦੇ ਹਨ ਅਤੇ ਗੇਮਾਂ ਵੱਲ ਵੀ ਬੱਚੇ ਬਹੁਤ ਆਕਰਸ਼ਿਤ ਹੁੰਦੇ ਹਨ ਉਹ ਆਪਣੀ ਪੜ੍ਹਾਈ ਵਗੈਰਾ ਸਭ ਕੁਝ ਛੱਡ ਕੇ ਗੇਮਾਂ ਵੱਲ ਜ਼ਿਆਦਾ ਅਤਰਕਤ ਹੁੰਦੇ ਹਨ ਜਿਸ ਦੀ ਵਜ੍ਹਾ ਜਿਸ ਵਜ੍ਹਾ ਨਾਲ ਉਹ ਜ਼ਿਆਦਾ ਬਾਹਰ ਖੇਡਦੇ ਕੁੱਦਦੇ ਨਹੀਂ ਅਤੇ ਫੋਨਾਂ ਵਿੱਚ ਜ਼ਿਆਦਾ ਰੁਚੀ ਰੱਖਦੇ ਹਨ ਸਾਨੂੰ ਇਸ ਕਰਕੇ ਬੱਚਿਆਂ ਨੂੰ ਇਸ ਇਸ ਗੱਲ ਵਿੱਚ ਦੇਖਭਾਲ ਕਰਨੀ ਚਾਹੀਦੀ ਹੈ ਜਿਵੇਂ ਕਿ ਬੱਚਿਆਂ ਦਾ ਇੱਕ ਪੂਰੇ ਦਿਨ ਦੇ ਵਿੱਚ ਫਿਕਸਡ ਟਾਈਮਟੇਬਲ ਬਣਾਉਣਾ ਚਾਹੀਦਾ ਹੈ ਕਿ ਉਹ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਫੋਨ ਚਲਾ ਸਕਦੇ ਹਨ ਅਤੇ ਫੋਨ ਵਿੱਚ ਕਿਸ ਪ੍ਰਕਾਰ ਦਾ ਕੰਟੈਂਟ ਬਹੁਤ ਦੇਖ ਸਕਦੇ ਹਨ ਜੇਕਰ ਅਸੀਂ ਇਸ ਤਰ੍ਹਾਂ ਨਾਲ ਚਲਾਂਗੇ ਤਾਂ ਹੀ ਬੱਚੇ ਉਹ ਸਮਝਣਗੇ ਕਿ ਸਾਨੂੰ ਫੋਨ ਕਿਸ ਪ੍ਰਕਾਰ ਨਾਲ ਚਲਾਉਣਾ ਚਾਹੀਦਾ ਹੈ ਅਤੇ ਕਿਹੜੀ ਚੀਜ਼ ਵਾਸਤੇ ਫੋਨ ਦੀ ਵਰਤੋਂ ਕਰਨੀ ਚਾਹੀਦੀ ਹੈ ਟੈਕਨੋਲੋਜੀ ਦੀ ਵਰਤੋਂ ਕਰਨੀ ਚਾਹੀਦੀ ਹੈ ਧੰਨਵਾਦ